ਅਸੀਂ ਆਪਣੇ ਘਰ ਵਿੱਚ ਮਨਚੂਰੀਅਨ ਬਣਾਉਂਦੇ ਹਨ ਇਹ ਇੱਕ ਚਾਈਨਾ ਦਾ ਦੀ ਡਿਸ਼ ਹੈ ਪਰ ਅਸੀਂ ਇਹਦੇ ਵਿੱਚ ਆਪਣੇ ਭਾਰਤ ਦੇ ਮਸਾਲੇ ਵੀ ਰਲਾਉਂਦੇ ਹਨ ਜਿਵੇਂ ਕਿ ਆਪਣਾ ਜ਼ੀਰਾ ਹੋਰ ਹਰੀ ਮਿਰਚ ਵਗੈਰਾ ਵੀ ਰਲਾ ਲੈਂਦੇ ਹਨ ਅਤੇ ਬੰਦ ਗੋਭੀ ਪੱਤਾ ਅਤੇ ਫੁੱਲ ਗੋਭੀ ਕੱਦੂ ਘੀਆ ਜਾ ਉਹ ਮਰਜ਼ੀ ਅਸੀਂ ਆਪਣਾ ਪੰਜਾਬੀ ਪਾ ਸਕਦੇ ਹਨ ਚਾਇਨੀਸ ਵਿੱਚ ਅਸੀਂ ਜ਼ਿਆਦਾ ਸੋਸ ਵਗੈਰਾ ਚਾਇਨੀਸ ਮਸਾਲਿਆਂ ਦੀ ਵਰਤੋਂ ਕਰ ਸਕਦੇ ਹਨ ਪੰਜਾਬੀ ਦੇ ਵਿੱਚ ਅਸੀਂ ਜੋ ਵੀ ਸਾਨੂੰ ਪਸੰਦ ਹੈ ਦੇਸੀ ਘਿਓ ਵਿੱਚ ਵੀ ਇਹਨੂੰ ਤਲ ਸਕਦੇ ਹਨ ਅਤੇ ਚਾਇਨੀਸ ਵਿੱਚ ਆਪਣਾ ਰਿਫਾਇੰਡ ਵਗੈਰਾ ਦੀ ਵਰਤੋਂ ਕਰ ਲੈਂਦੇ ਹਨ ਸਾਨੂੰ ਜ਼ਿਆਦਾ ਕਰਕੇ ਪੰਜਾਬੀਆਂ ਨੂੰ ਆਪਣਾ ਦੇਸੀ ਹੀ ਖਾਣਾ ਪਸੰਦ ਹੈ ਜਿਵੇਂ ਕਿ ਦੇਸੀ ਘਿਓ ਵਿੱਚ ਤਲਿਆ ਜਾਂਦਾ ਹੈ